ਜੇਕਰ ਅਸੀਂ ਮੇਰੀਆਂ ਕਮਜ਼ੋਰੀਆਂ ਦੀ ਗੱਲ ਕਰੀਏ ਤਾਂ ਮੇਰੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਨੇ ਬਟ ਤਿੰਨ ਚਾਰ ਐਸੀਆਂ ਕਮਜ਼ੋਰੀਆਂ ਨੇ ਜੋ ਕਿ ਮੈਨੂੰ ਬਹੁਤ ਜ਼ਿਆਦਾ ਵੱਡੀਆਂ ਕਮਜ਼ੋਰੀਆਂ ਆਪਣੇ ਵਿੱਚ ਲੱਗਦੀਆਂ ਹਨ ਜਿਨ੍ਹਾਂ ਕਿ ਜਿਨ੍ਹਾਂ ਵਿੱਚੋਂ ਪਹਿਲੀ ਕਮਜ਼ੋਰੀ ਇਹ ਹੈ ਕਿ ਮੈਂ ਅਗਰ ਕਿਸੇ ਵੀ ਭਾ ਭਾਸ਼ਣ ਮੁਕਾਬਲੇ ਵਿੱਚ ਜਾਂ ਦਸ ਪੰਦਰਾਂ ਜਣੇ ਸਾਹਮਣੇ ਕੁਛ ਵੀ ਬੋਲਣਾ ਹੋਵੇ ਤਾਂ ਮੈਨੂੰ ਬਹੁਤ ਹੀ ਔਕਵਰਡ ਜਿਹਾ ਫੀਲ ਹੁੰਦਾ ਆ ਅਤੇ ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਹੈ ਅਤੇ ਜੋ ਵੀ ਮੈਂ ਆਪਣਾ ਵਿਚਾਰ ਦੇਣਾ ਚਾਹੁੰਦਾ ਹਾਂ ਪਰ ਮੈਂ ਆਪਣੇ ਮਨ 'ਚ ਤਾਂ ਵਿਚਾਰ ਸੋਚ ਲੈਂਦਾ ਕਿ ਮੈਂ ਇਹ ਬੋਲਣਾ ਬਟ ਜਦੋਂ ਵੀ ਮੈਂ ਕਿਤੇ ਉਹਨਾਂ ਦੇ ਸਾਹਮਣੇ ਜਾਂਦਾ ਹਾਂ ਤਾਂ ਮੇਰੇ ਦਿਮਾਗ ਵਿੱਚ ਸਾਰੇ ਵਿਚਾਰ ਵਗੈਰਾ ਉੱਡ ਜਾਂਦੇ ਹਨ ਅਤੇ ਮੈਨੂੰ ਕੋਈ ਚੇਤਾ ਵੀ ਨਹੀਂ ਆਉਂਦਾ ਕਿ ਮੈਂ ਕੀ ਕੀ ਬੋਲਣਾ ਸੀਗਾ ਇੱਥੇ ਅਤੇ ਦੂਜੀ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਮੈਂ ਕਿਸੇ ਨੂੰ ਵੀ ਨਾ ਨਹੀਂ ਕਰ ਪਾਉਂਦਾ ਅਗਰ ਮੈਨੂੰ ਕੋਈ ਵੀ ਕਿਸੇ ਵੀ ਕੰਮ ਲਈ ਕਹਿੰਦਾ ਹੈ ਕਿ ਤੂੰ ਸਾਡੇ ਨਾਲ ਇੱਥੇ ਚੱਲ ਇੱਦਾਂ ਚਾਰ ਜਾਂ ਮੈਨੂੰ ਕੋਈ ਪੈਸੇ ਦੇ ਦੇ ਜਾਂ ਕੁਛ ਇੱਦਾਂ ਕਰ ਲਾ ਮੇਰੇ ਨਾਲ ਅਤੇ ਮੈਂ ਤੁਹਾਨੂੰ ਨਾ ਨਹੀਂ ਕਰ ਪਾਉਂਦਾ ਜਿਹੜੀ ਕਿ ਵਧੀਆ ਗੱਲ ਨਹੀਂ ਹੈਗੀ ਤੀਸਰੀ ਗੱਲ ਜਿਹੜੀ ਕਮਜ਼ੋਰੀ ਹੈ ਮੇਰੀ ਉਹ ਇਹ ਹੈ ਕਿ ਮੈਂ ਚਜ ਚੰਗੀ ਤਰਾਂ ਇੰਗਲਿਸ਼ ਵੀ ਨਹੀਂ ਬੋਲ ਪਾਉਂਦਾ ਜਿੱਦ ਜਿੱਦਾਂ ਕਿ ਮੈਂ ਆਪਣੀ ਇੰਗਲਿਸ਼ ਨੂੰ ਲਿਖ ਲੈਂਦਾ ਜਾਂ ਪੜ੍ਹ ਲੈਂਦਾ ਹਾਂ ਬਟ ਉਸ ਤਰੀਕੇ ਨਾਲ ਮੈਂ ਆਪਣੀ ਇੰਗਲਿਸ਼ ਨੂੰ ਬੋਲ ਕੇ ਨਹੀਂ ਬੋਲ ਨਹੀਂ ਸਕਦਾ ਅਤੇ ਅਗਰ ਜੇਕਰ ਅਸੀਂ ਆਪਣੀ ਸ਼ਕ ਮੇਰੀਆਂ ਸ਼ਕਤੀਆਂ ਦੀ ਗੱਲ ਕਰੀਏ ਤਾਂ ਮੈਂ ਬਹੁਤ ਹੀ ਮੋਟੀਵੇਟਰ ਹਾਂ ਅਤੇ ਜਿਵੇਂ ਕਿ ਹੁਣ ਸਾਡੀ ਪਲੇਸਮੈਂਟ ਦਾ ਟਾਈਮ ਆ ਲਾਸਟ ਹੈਗਾ ਵਾ ਸਾਡਾ ਯੀਅਰ ਕੋਲੇਜ ਦਾ ਅਤੇ ਮੇਰੇ ਸਾ ਕਾਫੀ ਸਾਰੇ ਫਰੈਂਡ ਨੂੰ ਸੁਣਿਆ ਹੈ ਕਿ ਨੌਕਰੀਆਂ ਨਹੀਂ ਮਿਲਦੀਆਂ ਪਈਆਂ ਅਤੇ ਬਟ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕੋਈ ਨਹੀਂ ਅਸੀਂ ਹੋਰ ਵੀ ਕੋਰਸ ਕਰਾਂਗੇ ਛੋਟੇ ਛੋਟੇ ਅਤੇ ਜਿਨ੍ਹਾਂ ਨਾਲ ਸਾਡੀ ਸੀ ਵੀ ਵਗੈਰਾ ਸਟਰੋਂਗ ਹੋਏਗੀ ਅਤੇ ਜਿਸ ਨਾਲ ਸਾਨੂੰ ਨੌਕਰੀਆਂ ਦੀਆਂ ਸੰਭਾਵਨਾ ਸਾਡੀ ਹੋਰ ਵੱਧ ਜਾਵੇਗੀ ਅਤੇ ਮੈਂ ਕਿਸੇ ਵੀ ਕੰਡੀਸ਼ਨ ਵਿੱਚ ਨਰਵਸ ਨਹੀਂ ਹੁੰਦਾ ਕੋਈ ਵੀ ਸਿਚੁਏਸ਼ਨ ਆ ਜੇ ਅਤੇ ਹਰ ਕਿਸੇ ਸਿਚੁਏਸ਼ਨ ਨੂੰ ਦਿਲ ਨਾਲ ਨਹੀਂ ਦਿਮਾਗ ਦੇ ਨਾਲ ਚੰਗੀ ਤਰ੍ਹਾਂ ਸੋਚ ਕੇ ਮੈਨੇਜ ਕਰਦਾ ਹਾਂ ਤੀਜੀ ਮੇਰੀ ਸ਼ਕਤੀ ਹੈਗੀ ਆ ਕਿ ਮੈਂ ਮੇਰੇ ਵਿੱਚ ਹਾਈਜ ਮੇਰੇ ਕੋਲ ਹਾਈ ਜਨਰਲ ਨੌਲੇਜ ਹੈਗੀ ਆ ਜਦੋਂ ਵੀ ਕਿਤੇ ਕੋਈ ਵੀ ਹੁੰਦੀ ਮੈਨੂੰ ਫੀਲਡ ਆ ਉਹਦੇ ਬਾਰੇ ਕੁਛ ਨਾ ਕੁਛ ਮੇਰੇ ਕੋਲ ਨੌਲੇਜ ਹੈ ਵਾ ਅਤੇ ਮੈਨੂੰ ਕਿਸੇ ਵੀ ਕੋਈ ਬੋਲਣ ਦਾ ਮਾੜਾ ਮੋਟਾ ਵੀ ਸਲਾਹ ਦੇਣ ਦਾ ਮੌਕਾ ਮਿਲਦਾ ਤਾਂ ਮੈਂ ਸਲਾਹ ਦੇ ਪਾਉਦਾ ਹਾਂ ਕਿ ਇਹਦੇ ਵਿੱਚ ਆਹ ਚੀਜ਼ ਇੱਦਾਂ ਹੋ ਸਕਦੀ ਆ